ਅੱਜ ਕੱਲ੍ਹ ਜੋ ਰੋਜ਼ੀ ਰੋਟੀ ਹੈ ਉਹ ਬਿਜਲੀ ਨਾਲ ਪ੍ਰਭਾਵਿਤ ਹੁੰਦੀ ਹੈ ਅਤੇ ਨਿਰਭਰ ਵੀ ਹੈ ਜਿਵੇਂ ਕਿ ਸਾਡੇ ਘਰ ਇੰਡਕਸ਼ਨ ਵੀ ਹੈ ਅਸੀਂ ਉਸ ਦੇ ਉੱਪਰ ਪਾਣੀ ਗਰਮ ਕਰ ਲਈਦਾ ਹੈ ਜਾਂ ਕੋਈ ਹੋਰ ਚੀਜ਼ਾਂ ਉਬਾਲਣੀਆਂ ਹੋਣ ਉਬਾਲ ਲਈ ਦੀਆਂ ਹੈ ਬਿਜਲੀ ਦੇ ਕੱਟ ਦੌਰਾਨ ਇਹ ਪ੍ਰਭਾਵਿਤ ਕੁਛ ਜ਼ਿਆਦਾ ਨਹੀਂ ਹੁੰਦਾ ਕਿਉਂਕਿ ਸਾਰਿਆਂ ਦੇ ਘਰ ਇਨਵਰਟਰ ਹੈਗੇ ਨੇ ਸ਼ਹਿਰਾਂ ਦੇ ਵਿੱਚ ਅੱਸੀ ਪ੍ਰਸੈਂਟ ਇਨਵਾਟਰ ਹੈਗੇ ਨੇ ਪਿੰਡਾਂ ਵਿੱਚ ਜਿਹੜੇ ਕਿ ਪਿਛੜੇ ਇਲਾਕੇ ਨੇ ਉਹਨਾਂ ਕੋਲ ਇਨਵਾਟਰ ਨਹੀਂ ਹਨ ਉਹਨਾਂ ਦੀ ਜਿਹੜੀ ਬਿਜਲੀ ਦੇ ਕੱਟ ਨਾਲ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਉਹਨਾਂ ਦੀ ਜਿਹੜੀ ਰੋਟੀ ਰੋਜ਼ੀ ਰੋਟੀ ਹੈ ਉਹ ਜ਼ਿਆਦਾਤਰ ਆਪਣੇ ਜਾਂ ਤਾਂ ਗੋਹੇ ਨਾਲ ਅਤੇ ਜਾਂ ਫਿਰ ਲੱਕੜਾਂ ਨਾਲ ਵੀ ਪੱਕਦੀ ਹੈ ਸਿਲੰਡਰ ਉਹਨਾਂ ਨੂੰ ਬਹੁਤ ਘੱਟ ਮਿਲਦਾ ਹੈ ਕਿਉਂਕਿ ਉਹ ਪਿਛੜੇ ਇਲਾਕੇ ਨੇ ਉੱਥੇ ਉਹ ਜਿਹੜੀ ਸੁਵਿਧਾ ਉਹ ਨਹੀਂ ਦਿੱਤੀ ਜਾਂਦੀ ਇਸ ਕਰਕੇ ਇਹ ਰੋਜ਼ੀ ਰੋਟੀ ਜਿਹੜੀ ਉਹ ਬਿਜਲੀ 'ਤੇ ਨਿਰਭਰ ਜਿਹੜੀ ਕਰਦੀ ਹੈ ਉਹ ਸਿਰਫ ਅਤੇ ਸਿਰਫ ਸ਼ਹਿਰਾਂ ਵਿੱਚ ਕਰਦੀ ਹੈ ਰੌਸ਼ਨੀ ਜਦੋਂ ਬਿਜਲੀ ਜਾਂਦੀ ਹੈ ਤਾਂ ਰੌਸ਼ਨੀ ਲਈ ਲੋਕ ਜਿਹਨਾਂ ਦੇ ਇਨਵਰਟ ਲੱਗਿਆ ਉਹ ਤਾਂ ਬੱਤੀਆਂ ਜਗਾ ਲੈਂਦੇ ਨੇ ਅਤੇ ਜਿਹਨਾਂ ਦੇ ਨਹੀਂ ਲੱਗੇ ਉਹ ਫਿਰ ਮੋਮਬੱਤੀਆਂ ਯੂਜ਼ ਕਰਦੇ ਹੈ ਵੈਕਸ ਕੈਂਡਲ ਜਿਹਨੂੰ ਕਹਿ ਸਕਦੇ ਹਾਂ ਉਹ ਬਹੁਤ ਪੁਰਾਣੇ ਸਮੇਂ ਦੀ ਚੀਜ਼ ਹੈ ਜੋ ਅੱਜ ਵੀ ਕਿਤੇ ਨਾ ਕਿਤੇ ਤੁਹਾਨੂੰ ਆਮ ਦੇਖਣ ਨੂੰ ਮਿਲ ਜਾਏਗੀ ਅਤੇ ਇਸ ਦਾ ਜ਼ਿਆਦਾ ਜਿਹੜਾ ਧਿਆਨ ਹੈ ਉਹ ਤੁਹਾਨੂੰ ਪਿੰਡਾਂ ਵਿੱਚ ਹੀ ਮਿਲੇਗਾ